ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਹੈਲੋ ਵਧੀਆ ਜੀ ਵਧੀਆ ਤੁਸੀਂ ਦੱਸੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਬਸ ਵਧੀਆ ਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਜੀ ਅੱਛਾ ਜੀ ਪੜ੍ਹਿਆ ਤਾਂ ਸੀਗਾ ਬਾਕੀ ਇੱਕ ਵਾਰ ਆਪਾਂ ਗੱਲ ਕਰਦੇ ਹਾਂ ਯਾਦ ਆ ਜਾਵੇਗਾ ਮੈਨੂੰ ਮੈਂ ਵੀ ਹੁਣ ਭੁੱਲੀ ਬੈਠਾ ਹਾਂ ਯਾਦ ਹੈ ਜਦੋਂ ਆਜ਼ਾਦੀ ਤੋਂ ਬਾਅਦ ਜਿਹੜਾ ਹੋਇਆ ਸੀ ਹਾਂ ਹਾਂ

ਕੀ ਕੀਤਾ ਸੀ ਜੀ ਅੱਛਾ ਕੀ ਫਰਕ ਪਿਆ ਦੱਸਿਓ ਮਾੜਾ ਜਿਹਾ ਹਾਂਜੀ ਹਾਂਜੀ ਅੱਛਾ ਇੰਨਾਂ ਅੱਛਾ ਇਕੱਲਾ ਇੰਨਾਂ ਫਰਕ ਗਿਆ ਇੰਨਾਂ ਫਰਕ ਪਾਤਾ ਸੀ ਹੈਂ ਪੰਜਾਬ ਨੇ ਫਿਰ ਅੱਛਾ ਅੱਛਾ ਅੱਛਾ ਮੈਂ ਵੀ ਹੁਣ ਯਾਦ ਆਇਆ ਨਾ ਹੁਣ ਮੈਨੂੰ ਵੀ ਮੈਨੂੰ ਵੀ ਹੁਣੇ ਯਾਦ ਆਇਆ ਜਦੋਂ ਤੁਸੀਂ ਮੈਨੂੰ ਦੱਸਿਆ ਨਾ ਮੈਨੂੰ ਵੀ ਹੁਣੇ ਯਾਦ ਆਇਆ ਜੇ ਮੈਂ ਵੀ ਹੁਣ ਭੁੱਲੀ ਬੈਠਾ ਸੀ ਭੁੱਲੀ ਬੈਠਾ ਸੀ ਸਭ ਕੁਛ ਅੱਛਾ ਇੰਨਾਂ ਕੁਛ ਹੋਇਆ ਸੀ ਹਾਂ ਪੰਜਾਬ ਨੇ ਇੰਨਾਂ ਹਮ ਬਸ ਉਹੀ ਵਧੀਆ ਰਿਹਾ ਆਪਣਾ ਟਾਈਮ ਵਧੀਆ ਰਿਹਾ ਬਟ ਅੱਜ ਦੀ ਤੁਹਾਡੇ ਪਿੰਡ ਵਿੱਚ ਮੁੰਡਿਆਂ ਨੂੰ ਹੈ ਹੀ ਨਹੀਂ ਮੁੰਡਿਆਂ ਨੂੰ ਬਾਹਰ ਜਾਣ ਦੀ ਉੱਠੀ ਹੋਈ ਹੈ ਹਾਂ ਬਸ ਉਹੀ ਗੱਲ ਹੈ ਮੱਤ ਮਾਰੀ ਵੀ ਆ ਪੰਜਾਬ ਹੁਣ ਦੇ ਅੱਜ ਦੇ ਟਾਈਮ 'ਚ ਬੱਚਿਆਂ ਦੀ ਹਾਂ ਕੋਈ ਫਾਇਦਾ ਹੀ ਨਹੀਂ ਹਮ ਉਹ ਤਾਂ ਹੈ ਜੀ ਚਲੋ ਕਰਦਾ ਤੁਹਾਨੂੰ ਜੀ ਮੈਂ ਮਾੜਾ ਕੰਮ 'ਚ ਉਲਝਿਆ ਹੋਇਆ ਸੀ